ਸਾਡੀ ਰੋਜ਼ੀ ਰੋਟੀ ਦਾ ਬਿਜਲੀ ਨਾਲ ਬਹੁਤ ਜ਼ਿਆਦਾ ਇੱਕ ਕਲੋਜ਼ ਸੰਬੰਧ ਹੈ ਅਸੀਂ ਦੇਖਦੇ ਹਾਂ ਕਿ ਜਦ ਬਿਜਲੀ ਚਲੀ ਜਾਂਦੀ ਹੈ ਤਾਂ ਅਸੀਂ ਪਾਣੀ ਵੀ ਨਹੀਂ ਭਰ ਸਕਦੇ ਜਿਹਦੇ ਨਾਲ ਜਿਹੜੀ ਸਰਲ ਚੀਜ਼ਾਂ ਹਨ ਅਸੀਂ ਨਹੀਂ ਬਣਾ ਸਕਦੇ ਜਿਵੇਂ ਕਿ ਚਾਵਲ ਸਬਜ਼ੀ ਰੋਟੀ ਆਦਿ ਅਸੀਂ ਦੇਖਦੇ ਹਨ ਕਿ ਬਿਜਲੀ ਦੇ ਨਾ ਹੋਣ ਨਾਲ ਨਾ ਹੀ ਅਸੀਂ ਫ਼ੋਨ ਵਗੈਰਾ ਜਾਂ ਕੋਈ ਇਲੈਕਟ੍ਰੋਨਿਕ ਆਈਟਮ ਚਾਰਜ ਕਰ ਸਕਦੇ ਹਨ ਅਤੇ ਨਾ ਹੀ ਹੋਰ ਕੋਈ ਚੀਜ਼ ਯੂਜ਼ ਕਰ ਸਕਦੇ ਹਨ ਜਿਵੇਂ ਕਿ ਇਲੈਕਟ੍ਰੋਨਿਕ ਮਿਕਸੀ ਗਰਾਈਂਡਰ ਆਦਿ ਹੋਰ ਚੀਜ਼ਾਂ ਸਾਡੀ ਜੇ ਬਿਜਲੀ ਚਲੀ ਜਾਵੇ ਤਾਂ ਨੋਰਮਲ ਜ਼ਿੰਦਗੀ 'ਤੇ ਕਾਫੀ ਪ੍ਰਭਾਵ ਪੈਂਦਾ ਹੈ ਲੋਕਾਂ ਨੂੰ ਕਰਨ ਲਈ ਚੀਜ਼ ਨਹੀਂ ਮਿਲਦੀ ਨਾ ਹੀ ਅਸੀਂ ਰੋਟੀ ਪਕਾ ਸਕਦੇ ਹਾਂ ਅਤੇ ਨਾ ਹੀ ਕੋਈ ਐਂਟਰਟੇਨਮੈਂਟ ਦਾ ਸੋਰਸ ਰਹਿੰਦਾ ਟੀਵੀ ਵਗੈਰਾ ਕੁਛ ਵੀ ਬਿਜਲੀ ਨਾਲ ਨਹੀਂ ਚੱਲਦਾ ਅਤੇ ਜਿਹੜੇ ਬਿਜਲੀ ਦੇ ਕੱਟ ਹੁੰਦੇ ਹਨ ਉਹਨਾਂ ਨਾਲ ਨੋਰਮਲ ਜ਼ਿੰਦਗੀ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਤੇ ਜੇਕਰ ਉਹ ਲੰਬੇ ਸਮੇਂ ਲਈ ਕੱਟ ਹੋ ਜਾਵੇ ਤਾਂ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਝੱਲਣੀ ਪੈ ਸਕਦੀਆਂ ਹਨ ਸਾਡੇ ਛੋਟੇ ਏਰੀਆ ਵਿੱਚ ਲੋਕਾਂ ਕੋਲ ਇਨਵਟਰ ਤਾਂ ਹੈ ਨਹੀਂ ਅਤੇ ਜਿਨ੍ਹਾਂ ਕੋਲ ਹੈ ਵੀ ਉਹ ਵੀ ਜ਼ਿਆਦਾ ਦੇਰ ਚੱਲਦੇ ਨਹੀਂ ਜਿਵੇਂ ਕਿ ਦੋ ਘੰਟੇ ਤੋਂ ਉੱਪਰ ਕਿਹੜਾ ਇਨਵਟਰ ਚੱਲੇਗਾ